ਮੈਂ ਮੁੰਬਈ ਘੁੰਮਣ ਗਈ ਸੀ ਉੱਥੇ ਦੇ ਲੋਕ ਬਹੁਤ ਮਿਲਣਸਾਰ ਸੀ ਮੌਸਮ ਬਹੁਤ ਵਧੀਆ ਸੀ ਅਤੇ ਦੇਖਣ ਯੋਗ ਬਹੁਤ ਥਾਵਾਂ ਵੀ ਸੀ ਖਾਣਾ ਬੜਾ ਵਧੀਆ ਸੀ ਜਦੋਂ ਸ਼ਾਮ ਨੂੰ ਅਸੀਂ ਬੀਚ ਉੱਤੇ ਗਏ ਤਾਂ ਉੱਥੇ ਸੂਰਜ ਡੁੱਬਣ ਦਾ ਨਜ਼ਾਰਾ ਵੇਖਣ ਯੋਗ ਸੀ ਬੜਾ ਵਧੀਆ ਲੱਗ ਰਿਹਾ ਸੀ